ਹੈਲੋ ਮੈਂ ਨਰਿੰਦਰ ਬੋਲਦੀ ਹਾਂ ਜੀ ਹਾਂਜੀ ਮੈਂ ਅੱਠ ਸੌ ਸੋਲਾਂ ਨੰਬਰ ਮਕਾਨ ਨੰਬਰ 'ਚ ਨਵੀਂ ਆਈ ਹਾਂ ਜੀ ਹਾਂਜੀ ਤੁਹਾਡੇ ਗੁਆਂਢ ਵਿੱਚ ਏ ਸਤਿ ਸ਼੍ਰੀ ਅਕਾਲ ਜੀ ਬਸ ਆਪਾਂ ਬਾਹਰ ਇੰਨਾ ਨਿੱਕਲੀ ਦਾ ਹੀ ਨਹੀਂ ਜੀ ਅੰਦਰ ਏ ਰਹੀਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਜ ਤੁਹਾਡੇ ਤੱਕ ਕੋਈ ਕੰਮ ਪੈ ਗਿਆ ਤਾਂ ਤੁਹਾਨੂੰ ਫੋਨ ਕਰ ਲਿਆ ਜੀ ਮੈਨੂੰ ਨਾ ਜੀ ਅਸਲ 'ਚ ਨਾ ਆਪਾਂ ਹੁਣ ਇੱਥੇ ਰਿਹੜੀਆਂ ਵਾਲੇ ਤਾਂ ਆਉਂਦੇ ਹੈ ਅਤੇ ਫਰੈਸ਼ ਸਬਜ਼ੀ ਨਹੀਂ ਹੁੰਦੀ ਅਤੇ ਨਾਲੇ ਨਾ ਮਹਿੰਗੀ ਬਹੁਤ ਲਗਾਉਂਦੇ ਹੈ ਸਬਜ਼ੀ ਵਾਲੇ ਅਤੇ ਹਾਂਜੀ ਹੁਣ ਮੈਨੂੰ ਇੱਥੇ ਦਾ ਹਿਸਾਬ ਕਿਤਾਬ ਦਾ ਪਤਾ ਨਹੀਂ ਇਹਦੀ ਫ਼੍ਰੇਸ਼ ਸਬਜ਼ੀ ਕਿੱਥੋਂ ਮਿਲਦੀ ਹੈ ਕੋਈ ਸਬਜ਼ੀ ਮੰਡੀ ਜਾਂ ਕੁਝ ਮੋਲ ਜਾਂ ਰਿਲਾਇੰਸ ਕੁਝ ਵੀ ਹੋਵੇ ਵੀ ਜੇ ਜਿੱਥੇ ਵਧੀਆ ਸਬਜ਼ੀ ਮਿਲ ਜਾਵੇ ਵਧੀਆ ਕੁਆਲਟੀ ਦੀ ਵਧੀਆ ਐਨ ਰੇਟ ਵੀ ਸਹੀ ਹੋਵੇ ਤੁਹਾਨੂੰ ਪਤਾ ਤਾਂ ਹੈ ਅੱਜਕੱਲ ਮਹਿੰਗਾਈ ਦਾ ਜ਼ਮਾਨਾ ਏ ਹੈ ਨਾ ਅਤੇ ਰੇਟ ਹਾਈ ਹੋਏ ਵੇ ਐਂ ਜੀ ਤਾਂ ਮੈਂ ਕਿਹਾ ਚਲੋ ਮੈਂ ਤੁਹਾਨੂੰ ਪੁੱਛਦੀ ਹਾਂ ਵੀ ਜੇ ਕਿਤੇ ਸਸਤੀ ਚੀਜ਼ ਮਿਲ ਜਾਵੇ ਅੱਛਿਆ ਜੀ ਅੱਛਿਆ ਜੀ ਅਤੇ ਆਪਣਾ ਅਤੇ ਆਪਣਾ ਜਿਹੜਾ ਮਤਲਬ ਕਿ ਮੰਡੀ ਦਾ ਟਾਇਮ ਮਤਲਬ ਕਿ ਦਿਨ ਵੀ ਹੈ ਕੋਈ ਵੀ ਕਿਸ ਦਿਨ ਮੰਡੀ ਲੱਗਦੀ ਆ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਤਾਂ ਮਤਲਬ ਕਿ ਰੇਟ ਐਨ ਸਹੀ ਹੁੰਦਾ ਸਬਜ਼ੀ ਦਾ ਠੀਕ ਹੈ ਠੀਕ ਹੈ ਕਦੋਂ ਜਾਣਾ ਏ ਜੀ ਤੁਸੀਂ ਠੀਕ ਹੈ ਜੀ ਫਿਰ ਤੁਸੀਂ ਮੈਨੂੰ ਦੱਸ ਦਿਓ ਆਪਾਂ ਚੱਲਾਂਗੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਓਕੇ ਬਾਏ